ਛੇ ਦੁੰ ਛੇ ਜੂਨ ਦੋ ਹਜ਼ਾਰ ਦੋ ਸੱਤ ਅਪ੍ਰੈਲ ਤਿੰ ਉੱਨੀ ਸੌ ਬਹੱਤਰ ਛੇ ਨਵੰਬਰ ਉੱਨੀ ਸੌ ਤੇਰ੍ਹਾਂ ਅੱਠ ਦਸੰਬਰ ਦੋ ਹਜ਼ਾਰ ਚਾਰ ਅਠਾਈ ਦਸੰਬਰ ਦੋ ਹਜ਼ਾਰ ਚਾਰ